ਪੇਂਟਿੰਗ ਸ਼ੁਰੂ ਕਰਨ ਲਈ ਮੈਂ ਪ੍ਰੇਰਨਾ ਦੀ ਵਰਤੋਂ ਕਰਦੀ ਹਾਂ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਦਾ ਸਕੈਚ ਦੇਖਣਾ ਪਸੰਦ ਕਰਦੇ ਹਨ ਇਸ ਲਈ ਮੈਂ ਬੱਚਿਆਂ ਦੇ ਕਾਰਟੂਨਸ ਦੀ ਪੇਂਟਿੰਗ ਬਣਾਉਂਦੀ ਹਾਂ ਉਸਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੁੰਦੇ ਨੇ ਅਤੇ ਉਹਨਾਂ ਨੂੰ ਉਹ ਸਭ ਬਹੁਤ ਪਸੰਦ ਆਉਂਦਾ ਹੈ